ਸਾਡੇ ਕਾਲਜ ਵਿੱਚ ਮੈਂ ਕਈ ਪ੍ਰਕਾਰ ਦੇ ਗੁਣ ਸਿਖਾਏ ਜਾਂਦੇ ਹਨ ਜਿਵੇਂ ਮਿੱਟੀ ਦੇ ਖਿਡੌਣੇ ਬਣਾਉਣਾ ਮਿੱਟੀ ਦੀ ਮੂਰਤੀਆਂ ਬਣਾਉਣਾ ਅਤੇ ਚਿੱਤਰਕਾਰੀ ਆਦਿ ਹੁਣ ਮਿੱਟੀ ਦੇ ਖਿਡੌਣੇ ਬਣਾਉਣ ਦੀ ਕਲਾ ਦੇ ਵਿੱਚ ਕਯਾ ਹੁੰਦਾ ਹੈ ਕਿ ਸਾ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਸਾਰਾ ਕੁਝ ਜ਼ਿਆਦਾਤਰ ਮਿੱਟੀ ਦਾ ਹੀ ਹੁੰਦਾ ਤਾ ਹੁਣ ਉਹ ਮਿੱਟੀ ਅਤੇ ਉਹਨਾਂ ਖਿਡੋਣਿਆਂ ਜਾਂ ਫਿਰ ਚੀਜ਼ਾਂ ਨੂੰ ਹੀ ਰੰਗ ਕਰਕੇ ਉਹਨੂੰ ਹੀ ਆਪਣੀ ਕਲਾ ਦੇ ਰੂਪ ਵਿੱਚ ਪੇਸ਼ ਕਰਦੇ ਸਨ ਪੁਰਾਣੇ ਜ਼ਮਾਨੇ ਵਿੱਚ ਉਹ ਦੇਸੀ ਰੰਗਾਂ ਦਾ ਇਸਤੇਮਾਲ ਕਰਕੇ ਔਰ ਦੇਸੀ ਚੀਜ਼ਾਂ ਦਾ ਇਸਤੇਮਾਲ ਕਰਕੇ ਹੀ ਆਪਣਾ ਸਾਰਾ ਅ ਸਮਾਨ ਬਣਾਉਂਦੇ ਸਨ ਬਟ ਜਿਵੇਂ ਜਿਵੇਂ ਹੁਣ ਨਇਆ ਸਮੇਂ ਆਉਂਦਾ ਜਾ ਰਿਹਾ ਹੈ ਵਿਦੇਸ਼ੀ ਕਲਾ ਸਾਡੇ ਸਮਾਨ ਸਾਡੀ ਕਲਾ ਦੇ ਵਿੱਚ ਵੀ ਮਿਕ ਮਿਲਦੀ ਜਾ ਰਹੀ ਹੈ ਉਸਦੇ ਮਿਲਣ ਦੇ ਨਾਲ ਇੱਕ ਹਾਈਬਰਿਡ ਕਿਸਮ ਦਾ ਕਲਾ ਦਾ ਰੂਪ ਤਿਆਰ ਹੁੰਦਾ ਜਾ ਰਿਹਾ ਅਤੇ ਇਸ ਹਾਈਬਰਿਡ ਕਲਾ ਦੇ ਨਾਲ ਨਵੇਂ ਨਵੇਂ ਨਿਯਮ ਬਣ ਰਹੇ ਹਨ ਹਰੇਕ ਕਲਾ ਦੇ ਲਈ ਜਿਵੇਂ ਜਿਵੇਂ ਅਸੀਂ ਕਹਿ ਸਕਦੇ ਹਨ ਕਿ ਮਿੱਟੀ ਦੇ ਖਿਡੌਣੇ ਬਣਾਉਣ ਲਈ ਅਲੱਗ ਅਲੱਗ ਨਵੀਂ ਨਵੀਂ ਤਕਨੀਕਾਂ ਵਰਤੀਆਂ ਜਾ ਸਕਦੀਆਂ ਹਨ ਅਤੇ ਨਵੇਂ ਨਵੇਂ ਨਿਯਮ ਬਣ ਗਏ ਹਨ ਚਿੱਤਰਕਾਰੀ ਦੇ ਲਈ ਆਦਿ